ਹਾਲ ਹੀ ਵਿੱਚ ਆਏ ਇੱਕ ਤੂਫਾਨ ਨੇ ਤੁਹਾਡੇ ਸਾਡੇ ਘਰ ਦੇ ਬਾਹਰ ਟੈਲੀਫੋਨ ਦੀਆਂ ਤਾਰਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਜਿਸ ਦੇ ਨਤੀਜੇ ਵਜੋਂ ਸਾਡੀ ਲੈਡ ਲਾਈਨ ਸੇਵਾ ਵਿੱਚ ਬਹੁਤ ਵਿਘਨ ਪਿਆ ਹੈ ਅਤੇ ਸਾਨੂੰ ਇਹਨੂੰ ਸਹੀ ਕਰਵਾਉਣ ਲਈ ਤੁਰੰਤ ਸਹਾਇਤਾ ਦੀ ਲੋੜ ਹੈ ਕਿਉਂਕਿ ਅਸੀਂ ਆਪਣੇ ਸ਼ਹਿਰ ਤੋਂ ਅਤੇ ਆਪਣੇ ਰਿਸ਼ਤੇਦਾਰਾਂ ਤੋਂ ਬਹੁਤ ਦੂਰ ਹਾਂ ਜਿਸ ਦੇ ਲਈ ਸਾਨੂੰ ਉਹਨਾਂ ਨਾਲ ਗੱਲ ਕਰਨ ਲਈ ਲੈਡ ਲਾਈਨ ਦੀ ਬਹੁਤ ਜ਼ਰੂਰਤ ਹੈ ਕਿਰਪਾ ਕਰਕੇ ਸਾਡੀ ਲੈਡ ਲਾਈਨ ਜਲਦੀ ਸੇਵਾ ਮੋਹਾਲ ਕਰਵਾਈ ਜਾਵੇ